ਹੈਲੋ ਹਾਂਜੀ ਕੀ ਹਾਲ ਹੈ ਹੋਰ ਕੀ ਕਰਦੇ ਸੀ ਅੱਛਾ ਮੈਂ ਪੁੱਛਣਾ ਸੀ ਵੀ ਤੁਹਾਨੂੰ ਫਤਿਹਗੜ੍ਹ ਸਾਹਿਬ ਦੀ ਹਿਸਟਰੀ ਮਤਲਬ ਇਤਿਹਾਸ ਬਾਰੇ ਪਤਾ ਏ ਹਾਂਜੀ ਦੱਸੋ ਹਾਂਜੀ ਇੱਕ ਤਾਂ ਉਰੇ ਗੁਰਦੁਆਰਾ ਸਾਹਿਬ ਆ ਹਾਂਜੀ ਹਾਂ ਇੱਥੇ ਤਾਂ ਗੁਰਦੁਆਰਾ ਸਾਹਿਬ ਦਾ ਇੰਨਾਂ ਜ਼ਿਆਦਾ ਮਤਲਬ ਉਹ ਆ ਜਿਹੜੇ ਛੋਟੇ ਛੋਟੇ ਬੱਚੇ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਇਸ ਕਰਕੇ ਬਹੁਤ ਜ਼ਿਆਦਾ ਇਤਿਹਾਸਿਕ ਹੋ ਹੋ ਗਿਆ ਸਾਰੇ ਔਲ ਇੰਡੀਆ ਵਿੱਚ ਬਾਹਰ ਦੇ ਲੋਕ ਵੀ ਇੱਥੇ ਆ ਕੇ ਮਤਲਬ ਫੋਰਨ ਕੰਟਰੀ ਤੋਂ ਆਉਂਦੇ ਨੇ ਜਿਹੜੇ ਉਹ ਵੀ ਦਰਸ਼ਨ ਕਰਕੇ ਜਾਂਦੇ ਨੇ ਇੱਥੇ ਹੋਰ ਹਾਂ ਹਾਂ ਹਾਂ ਹਾਂ ਮਤਲਬ ਉਵੇਂ ਹੀ ਬਣੀ ਹੋਈ ਆ ਤੁਸੀਂ ਦੇਖਿਆ ਅੰਦਰ ਜਾ ਕੇ ਉਵੇਂ ਹੀ ਬਣਿਆ ਹੋਇਆ ਉਹਨਾਂ ਦਾ ਸਥਾਨ ਉੱਥੇ ਭੋਰਾ ਸਾਹਿਬ ਦੇ ਵਿਚ ਹਾਂ ਭੋਰਾ ਸਾਹਿਬ ਵਿੱਚ ਬਣਿਆ ਹੋਇਆ ਹਾਂ ਹਾਂ ਕਿ ਸਭ ਤੋਂ ਮਹਿੰਗੀ ਖਰੀਦੀ ਸੀ ਉਹਨਾਂ ਨੇ ਆਮ ਖਾਸ ਬਾਗ ਆ ਜਿਵੇਂ ਹਾਂ ਇਹ ਵੀ ਵਧੀਆ ਹਾਂ ਹਾਂ ਜਹਾਂਗੀਰ ਸੀ ਜਿਹੜਾ ਮਤਲਬ ਆਉਂਦਾ ਸੀਗਾ ਇੱਥੇ ਲਾਹੌਰ ਤੋਂ ਦਿੱਲੀ ਜਾਂਦਾ ਸੀਗਾ ਇੱਥੇ ਰੁਕ ਕੇ ਜਾਂਦਾ ਸੀਗਾ ਹਾਂ ਅਸੀਂ ਵੀ ਏ ਇੱਕ ਵਾਰ ਗਏ ਸੀ ਅੰਦਰੋਂ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਮਤਲਬ ਕਿ ਪੁਰਾਣੀ ਬਿਲਡਿੰਗ ਆ ਉਹ ਜਿਹੜੀ ਸਰਹੰਦੀ ਇੱਟਾਂ ਹੁੰਦੀਆਂ ਨੇ ਉਹ ਲੱਗੀਆਂ ਹੁੰਦੀਆਂ ਨੇ ਇੱਥੇ ਮਤਲਬ ਅੰਦਰ ਖੂਹ ਵਗੈਰਾ ਬਣਾਏ ਹੋਏ ਨੇ ਰਹਿਣ ਵਾਸਤੇ ਕੰਧਾਂ ਦੇ ਵਿੱਚੋਂ ਨਾ ਪਾਈਪ ਲ ਕੰਧਾਂ ਦੇ ਵਿੱਚ ਨੂੰ ਪਾਈਪ ਲੱਗੇ ਹੋਏ ਨੇ ਉਹਨਾਂ ਵਿੱਚ ਦੇ ਗਰਮ ਪਾਣੀ ਅਤੇ ਠੰਡਾ ਪਾਣੀ ਜਾਂਦਾ ਸੀਗਾ ਅੰਦਰ ਖੂਹ ਜੇ ਬਣੇ ਹੋਏ ਸੀਗੇ ਉੱਥੇ ਮਤਲਬ ਕਿ ਅੰਦਰੇ ਰਾਣੀਆਂ ਵਗੈਰਾ ਨਹਾਉਂਦੀਆਂ ਸੀ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਹਾਂ ਪਾਣੀ ਦੀ ਵੇਸਟਿੰਗ ਬਿਲਕੁਲ ਨਹੀਂ ਸੀਗੀ ਇੰਨੀ ਮਤਲਬ ਅੰਡਰਗਰਾਊਂਡ ਪਾਈਪ ਲੱਗੇ ਹੋਏ ਨੇ ਨਾ ਬਾਹਰ ਜਾ ਕੇ ਪਾਣੀ ਜਿਹੜਾ ਮਤਲਬ ਬਾਗ ਬਗੀਚੇ ਲੱਗੇ ਹੋਏ ਨੇ ਉੱਥੇ ਜਾ ਕੇ ਪਾਣੀ ਨਿਕਲਦਾ ਸਾਰਾ

ਹੋਰ ਹਾਂ ਹਾਂ ਬਹੁਤ ਜ਼ਿਆਦਾ ਹਾਂ ਹੋਰ ਚਲੋ ਕਦੇ ਇਕੱਠੇ ਜਾ ਕੇ ਘੁੰਮ ਕੇ ਆਵਾਂਗੇ ਠੀਕ ਹੈ ਠੀਕ ਹੈ ਓਕੇ ਬਾਏ